ਬ੍ਰਹਿਮੰਡ ਦਾ ਇਤਿਹਾਸ ਅਤੇ ਇਹ ਕਿਵੇਂ ਵਿਕਸਿਤ ਹੋਇਆ ਇਸ ਨੂੰ ਮੋਟੇ ਤੌਰ 'ਤੇ ਬਿਗ ਬੈਂਗ ਮਾਡਲ ਵੱਲੋਂ ਸਵੀਕਾਰ ਕੀਤਾ ਜਾਂਦਾ ਹੈ ਜੋ ਦੱਸਦਾ ਹੈ ਕਿ ਬ੍ਰਹਿਮੰਡ ਲਗਭਗ ਤੇਰਾਂ ਪੁਆਇੰਟ ਸੱਤ ਅਰਬ ਸਾਲ ਪਹਿਲਾਂ ਇੱਕ ਵਿਸ਼ਵਾਸ ਜੋ ਗਰਮ ਸੰਘਣੇ ਬਿੰਦੂ ਵਜੋਂ ਸ਼ੁਰੂ ਹੋਇਆ ਸੀ ਤਾਂ ਫਿਰ ਬ੍ਰਹਿਮੰਡ ਇੱਕ ਇੰਚ ਕੁੱਲ ਮਿਲੀਮੀਟਰ ਦੇ ਅੰਸ਼ ਤੋਂ ਅੱਜ ਦੀ ਸਥਿਤੀ ਵਿੱਚ ਕਿਵੇਂ ਗਿਆ ਇੱਥੇ ਬਿਗ ਬੈਗ ਦਾ ਹੁਣ ਤੱਕ ਦਾ ਆਸਾਨ ਕਦਮਾਂ ਵਿੱਚ ਵਿਸਤਾਰ ਹੈ ਬਿਗ ਬੈਗ ਪੁਲਾੜ ਵਿੱਚ ਇੱਕ ਧਮਾਕਾ ਨਹੀਂ ਸੀ ਜਿਵੇਂ ਕਿ ਥਿਊਰੀ ਦੇ ਨਾਮ ਤੋਂ ਪਤਾ ਲੱਗਦਾ ਹੈ ਖੋਜ ਕਰਤਾਵਾਂ ਨੇ ਕਿਹਾ ਕਿ ਇਸ ਦੀ ਬਜਾਏ ਇਹ ਬ੍ਰਹਿਮੰਡ ਵਿੱਚ ਹਰ ਜਗ੍ਹਾ ਪੁਲਾੜ ਦੀ ਦਿੱਖ ਸੀ ਬਿਗ ਬੈਗ ਥਿਊਰੀ ਦੇ ਅਨੁਸਾਰ ਬ੍ਰਹਿਮੰਡ ਦਾ ਜਨਮ ਪੁਲਾੜ ਵਿੱਚ ਇੱਕ ਬਹੁਤ ਹੀ ਗਰਮ ਸੀ ਬਹੁਤ ਸੰਘਣੇ ਸਿੰਗਲ ਪੁਆਇੰਟ ਵੱਲੋਂ ਹੋਇਆ ਸੀ ਕਾਸਮੋਲੋਜਿਸਟ ਨੂੰ ਪੱਕਾ ਪਤਾ ਨਹੀਂ ਹੈ ਪਰ ਇਸ ਪਲ ਤੋਂ ਪਹਿਲਾਂ ਕੀ ਹੋਇਆ ਪਰ ਅਤਿ ਆਧੁਨਿਕ ਪੁਲਾੜ ਮਿਸ਼ ਮਿਸ਼ਨਾਂ ਜ਼ਮੀਨ ਅਧਾਰਤ ਟੈਲੀਸਕੋਪਾਂ ਅਤੇ ਗੁੰਝਲਦਾਰ ਗਣਨਾਵਾਂ ਨਾਲ ਵਿਗਿਆਨੀ ਸ਼ੁਰੂਅਤ ਬ੍ਰਹਿਮੰਡ ਅਤੇ ਇਸਦੇ ਗਠਨ ਦੀ ਸਪਸ਼ਟ ਤਸਵੀਰ ਪੇਸ਼ ਕਰਨ ਲਈ ਕੰਮ ਕਰ ਰਹੇ ਹਨ ਇਸ ਦਾ ਇੱਕ ਮਹੱਤਵਪੂਰਨ ਹਿੱਸਾ ਬ੍ਰਹਿਮੰਡ ਮੈਕਰੋਵੇਵ ਪਿਛੋਕੜ ਦੇ ਨਿਰਖਣਾਂ ਤੋਂ ਆਉਂਦਾ ਹੈ ਜਿਸ ਵਿੱਚ ਬਿਗ ਬੈਗ ਤੋਂ ਬਚੀ ਰੋਸ਼ਨੀ ਅਤੇ ਰੇਡੀਏਸ਼ਨ ਦੇ ਬਾਅਦ ਦੀ ਚਮਕ ਸ਼ਾਮਲ ਹੈ ਬਿਗ ਬੈਂਗ ਦੀ ਇਹ ਨਿਸ਼ਾਨੀ ਬ੍ਰਹਿਮੰਡ ਵਿੱਚ ਫੈਲੀ ਹੋਈ ਹੈ ਮੈਕਰੋਵੇਵ ਡਟੈਕਟਰਾਂ ਨੂੰ ਦਿਖਾਈ ਦਿੰਦੀ ਹੈ ਜੋ ਵਿਗਿਆਨੀਆਂ ਨੂੰ ਸ਼ੁਰੂਅਤ ਬ੍ਰਹਿਮੰਡ ਦੇ ਸੁਰਾਖ ਇਕੱਠੇ ਕਰਨ ਦੀ ਆਗਿਆ ਦਿੰਦੀ ਹੈ ਦੋ ਹਜ਼ਾਰ ਇੱਕ ਵਿੱਚ ਨਾਸਾ ਨੇ ਵਿਲਕਿਨਸਨ ਮੈਕਰੋਵੇਵ ਐਨੀਸੋਟ੍ਰੋਪੀ ਪ੍ਰੋਗ ਮਿਸ਼ਨ ਦੀ ਸ਼ੁਰੂਆਤ ਕੀਤੀ ਤਾਂ ਜੋ ਬ੍ਰਹਿਮੰਡ ਦੇ ਮੈਕਰੋਵੇਵ ਪਿਛੋਕੜ ਅਤੇ ਰੇਡੀਏਸ਼ਨ ਨੂੰ ਮਾਪ ਕੇ ਸ਼ੁਰੂਆਤੀ ਬ੍ਰਹਿਮੰਡ ਵਿੱਚ ਮੌਜੂਦ ਸਥਿਤੀਆਂ ਦਾ ਅਧਿਐਨ ਕੀਤਾ ਜਾ ਸਕੇ ਹੋਰ ਖੋਜਾਂ ਦੇ ਨਾਲ ਡਬਲਯੂ ਏ ਪੀ ਬ੍ਰਹਿਮੰਡ ਦੀ ਉਮਰ ਨਿਰਧਾਰਤ ਕਰਨ ਦੇ ਯੋਗ ਸੀ ਜਦੋਂ ਬ੍ਰਹਿਮੰਡ ਬਹੁਤ ਛੋਟਾ ਸੀ ਇੱਕ ਸਕਿੰਟ ਦੇ ਇੱਕ ਟ੍ਰੀਲੀਅਨ ਦੇ ਹਿੱਸੇ ਦਾ ਸੌਵਾਂ ਹਿੱਸਾ ਜਿਸ ਵਿੱਚ ਹੈਰਾਨੀਜਨਕ ਵਿਕਾਸੀ ਤੇਜ਼ੀ ਆਈ ਵਿਸਥਾਰ ਦੇ ਇਸ ਧਮਾਕੇ ਦੌਰਾਨ ਇਸ ਨੂੰ ਮਹਿਵਾਈ ਵਜੋਂ ਜਾਣਿਆ ਜਾਂਦਾ ਹੈ ਬ੍ਰਹਿਮੰਡ ਤੇਜ਼ੀ ਨਾਲ ਵਧਿਆ ਆਕਾਰ ਵਿੱਚ ਘੱਟੋ ਘੱਟ ਨੱਬੇ ਗੁਣਾ ਦੁੱਗਣਾ ਹੋ ਗਿਆ